ਅਸੀਂ ਪੰਜਾਬ ਵਿੱਚ ਬਠਿੰਡੇ ਦੇ ਰਹਿਣ ਵਾਲੇ ਹਾਂ ਇੱਥੇ ਸਭ ਤੋਂ ਮਸ਼ਹੂਰ ਪੁਰਾਣਾ ਕੌਲਜ ਰਜਿੰਦਰਾ ਕੌਲਜ ਹੈ ਜੋ ਕਿ ਸ਼ਹਿਰ ਦੇ ਬਿਲਕੁਲ ਵਿਚਾਲੇ ਹੈ ਉਸ ਤੋਂ ਬਾਅਦ ਗਿਆਨੀ ਜੈਲ ਸਿੰਘ ਕੌਲਜ ਹੈ ਜੋ ਇੱਕ ਇੰਜੀਨੀਅਰਿੰਗ ਕੌਲਜ ਹੈ ਉਸ ਦੇ ਨਾਲ ਹੀ ਹੁਣ ਉੱਥੇ ਗਿਆਨੀ ਜੈਲ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਣ ਗਈ ਹੈ ਔਰ ਬਾਬਾ ਫਰੀਦ ਕੌਲਜ ਔਰ ਯੂਨੀਵਰਸਿਟੀ ਵੀ ਇੱਥੇ ਜੋ ਹੈ ਉਹ ਬਹੁਤ ਮਸ਼ਹੂਰ ਹੈ ਔਰ ਪੰਜਾਬ ਸੈਂਟਰ ਯੂਨੀਵਰਸਿਟੀ ਵੀ ਬਠਿੰਡਾ ਦੇ ਇਲਾਕੇ ਵਿੱਚ ਹੀ ਬਣਾਈ ਗਈ ਹੈ ਜਿਨ੍ਹਾਂ ਵਿੱਚ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਉਹ ਪੜ੍ਹਦੇ ਨੇ ਔਰ ਸਾਡੀ ਪਰਿਵਾਰ ਵਿੱਚੋਂ ਇਹਨਾਂ ਵਿੱਚੋਂ ਸਾਡੇ ਜੋ ਬੱਚੇ ਹੈ ਉਹ ਜ਼ਿਆਦਾਤਰ ਬਾਬਾ ਫਰੀਦ ਕੌਲਜ ਵਿੱਚ ਪੜ੍ਹੇ ਹਨ ਜਿਨ੍ਹਾਂ ਨੇ ਐੱਮ ਐੱਸ ਸੀ ਐਗਰੀਕਲਚਰ ਵਿੱਚ ਉੱਥੋਂ ਕਰੀ ਸੀ ਅਤੇ ਇੱਕ ਬਰਦਰ ਹੈ ਜੋ ਕਿ ਗਿਆਨੀ ਜੈਲ ਸਿੰਘ ਕੌਲਜ 'ਚੋਂ ਜਿਸ ਨੇ ਬੀ ਟੈਕ ਕਰੀ ਸੀ ਔਰ ਵੱਡੇ ਬਰਦਰ ਨੇ ਵੀ ਉੱਥੋਂ ਹੀ ਗਿਆਨੀ ਜੈਲ ਸਿੰਘ 'ਚੋਂ ਬੀ ਟੈਕ ਕਰੀ ਸੀਗੀ ਔਰ ਜੋ ਹੁਣ ਦੇ ਬੱਚੇ ਹੈ ਉਹਨਾਂ ਨੂੰ ਅਸੀਂ ਸਲਾਹ ਦੇਵਾਂਗੇ ਕਿ ਪੰਜਾਬ ਯੂਨੀਵਰਸ ਪੰਜਾਬ ਸੈਂਟਰ ਯੂਨੀਵਰਸਿਟੀ ਹੈ ਜੋ ਉਹ ਵੀ ਬਹੁਤ ਵਧੀਆ ਹੈ ਅਤੇ ਉੱਥੇ ਹਰ ਸਬਜੈਕਟ ਪੜ੍ਹਾਇਆ ਜਾਂਦਾ ਹੈ ਅਤੇ ਉੱਥੇ ਵੱਧ ਤੋਂ ਵੱਧ ਬੱਚੇ ਦਾਖਲਾ ਲੈਣ ਅਤੇ ਆਪਣੀ ਪੜ੍ਹਾਈ ਪੂਰੀ ਕਰਨ